ਮੈਂ ਕਿਤਾਬਾਂ ਆਪਣੇ ਰੋਪੜ ਸ਼ਹਿਰ ਦੇ ਵਿੱਚੋਂ ਖਰੀਦਦਾ ਹਾਂ ਇੱਥੇ ਬਹੁਤ ਸਾਰੀ ਕਿਤਾਬਾਂ ਦੀ ਸਟੋਰ ਜਿਹੜੇ ਉਪਲਬਧ ਹਨ ਜਿਵੇਂ ਕਿ ਕੱਕੜ ਬੁੱਕ ਹਾਊਸ ਅਤੇ ਹਰਭਜਨ ਬੁੱਕ ਸਟੋਰ ਜਿਹੜੇ ਕਿ ਚਾਲ਼ੀ ਪਰਸੈਂਟ ਡਿਸਕਾਉਂਟ ਦੇ ਉੱਤੇ ਸਕੂਲੀ ਬੱਚਿਆਂ ਅਤੇ ਹੋਰਾਂ ਨੂੰ ਵੀ ਕਿਤਾਬਾਂ ਦਿੰਦੇ ਹਨ ਇੱਥੋਂ ਤੱਕ ਕਿ ਮੈਂ ਗਿਆਰਾਂ ਸੈਕਟਰ ਚੰਡੀਗੜ੍ਹ ਦੇ ਵਿੱਚ ਸੱਠ ਪਰਸੈਂਟ ਡਿਸਕਾਉਂਟ ਦੇ ਉੱਤੇ ਵੀ ਕਿਤਾਬਾਂ ਖਰੀਦਦਾ ਹੁੰਦਾ ਸੀ ਜਿਹੜੇ ਕਿ ਟੈਕਨੋਲੋਜੀ ਅਤੇ ਕਮਿਉਨੀਕੇਸ਼ਨ ਦੇ ਆਧਾਰ 'ਤੇ ਹੁੰਦੀਆਂ ਸਨ ਉਹਦੇ ਨੇੜੇ ਹੀ ਬਾਈ ਸੈਕਟਰ ਅਟਾਵਾਸ ਹੈ ਅਟਾ ਅਟਾਵਾ ਬੁੱਕ ਸਟੋਰ ਹੈ ਜਿੱਥੇ ਕਿ ਬਹੁਤ ਸਾਰੀਆਂ ਕਿਤਾਬਾਂ ਮੌਜੂਦ ਹਨ ਮੈਨੂੰ ਇਤਿਹਾਸਕ ਅਤੇ ਧਾਰਮਿਕ ਕਹਾਣੀਆਂ ਪੜ੍ਹਨੀਆਂ ਬਹੁਤ ਜ਼ਿਆਦਾ ਪਸੰਦ ਹਨ ਮੈਂ ਜ਼ਿਆਦਾਤਰ ਬੁੱਕਾਂ ਧਾਰਮਿਕ ਕਿਤਾਬਾਂ ਮੈਂ ਭੱਠਾ ਸਾਹਿਬ ਦੇ ਉੱਤੇ ਲੇ ਭੱਠਾ ਸਾਹਿਬ ਤੋਂ ਖਰੀਦਦਾ ਹਾਂ ਜਿੱਥੇ ਕਿ ਲਿਟਰੇਚਰ ਹਾਊਂਸ ਵੀ ਜਿਹੜਾ ਮੌਜੂਦ ਹੈ ਜਿੱਥੋਂ ਅਸੀਂ ਸਸਤੀਆਂ ਅਤੇ ਚੰਗੀਆਂ ਕਿਤਾਬਾਂ ਖਰੀਦ ਸਕਦੇ ਹਨ ਸ੍ਰੀ ਅਨੰਦਪੁਰ ਸਾਹਿਬ ਵੀ ਹੋਰ ਲਿਟਰੇਚਰ ਹਾਊਂਸ ਹੈ ਜਿੱਥੋਂ ਕਿ ਮੈਂ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਖਰੀਦਦਾ ਹਨ ਲਵ ਸਟੋਰੀ ਦੀਆਂ ਕਿਤਾਬਾਂ ਮੇਰੇ ਕੋਲ ਬਹੁਤ ਜ਼ਿਆਦਾ ਮੌਜੂਦ ਹਨ ਮੇਰੇ ਘਰ ਦੇ ਵਿੱਚ ਵੀ ਇੱਕ ਛੋਟੀ ਜਿਹੀ ਲਾਈਬ੍ਰੇਰੀ ਹੈ ਜਿੱਥੇ ਮੈਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਹਨ ਜਦੋਂ ਵੀ ਮੈਂ ਚੰਡੀਗੜ੍ਹ ਜਾਂ ਅਨ ਅਨੰਦਪੁਰ ਸਾਹਿਬ ਜਾਂ ਕਿਸੇ ਗੁਰਦੁਆਰਾ ਸਾਹਿਬ ਜਾਂਦਾ ਮੈਂ ਧਾਰਮਿਕ ਪੁਸਤਕਾਂ ਉੱਥੋਂ ਜ਼ਰੂਰ ਖਰੀਦਦਾ ਹਾਂਂ ਅਤੇ ਮੈਂ ਉਹਨੂੰ ਆਪਣੀ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਕਰਦਾ ਹਾਂ ਅਤੇ ਮੇਰੇ ਰਿਸ਼ਤੇਦਾਰ ਅਤੇ ਮੇਰੇ ਹੋਰ ਫੈਮ ਸਾਰੀ ਫ਼ੈਮਿਲੀ ਮੈਂਬਰ ਮ ਉੱਥੋਂ ਸਾਰੇ ਇਹ ਬੁੱਕਾਂ ਜਿਹੜੀਆਂ ਖਰੀਦਦੇ ਹਨ ਅਤੇ ਇਨ੍ਹਾਂ ਕਿਤਾਬਾਂ ਨੂੰ ਖਰੀਦ ਕੇ ਪੜ੍ਹ ਕੇ ਉਨ੍ਹਾਂ ਦਾ ਲਾਹਾ ਲੈਂਦੇ ਹਨ